ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਕਿਸੇ ਵਿਅਕਤੀ ਲਈ ਸਾਡੇ ਪਿੰਡ ਵਿੱਚ ਕਈ ਘਰੇਲੂ ਉਪਚਾਰ ਹਨ ਇੱਕ ਤਾਂ ਸਾਨੂੰ ਪਹਿਲਾਂ ਤੋਂ ਉਹ ਦੱਸਿਆ ਗਿਆ ਹੈ ਕਿ ਸਾਨੂੰ ਸਵੇਰੇ ਉੱਠ ਕੇ ਗਰਮ ਪਾਣੀ ਪੀ ਪੀਣਾ ਚਾਹੀਦਾ ਉਹਦੇ ਨਾਲ ਵੀ ਭਾਰ 'ਚ ਕਾਫੀ ਗਿਰਾਵਟ ਆਉਂਦੀ ਹੈ ਅਤੇ ਉਸ ਤੋਂ ਇਲਾਵਾ ਗਰਮ ਪਾਣੀ ਵਿੱਚ ਨਿੰਬੂ ਨਿਚੋੜ ਕੇ ਪੀਓ ਉਸ ਨਾਲ ਵੀ ਬੜਾ ਫਾਇਦਾ ਹੁੰਦਾ ਹੈ ਭਾਰ ਘਟਾਉਣ 'ਚ ਅਤੇ ਗਰਮ ਪਾਣੀ ਵਿੱਚ ਸ਼ਹਿਦ ਪਾ ਕੇ ਪੀਓ ਤਾਂ ਉਸ ਨਾਲ ਵੀ ਭਾਰ ਘਟਾਉਣ ਵਿੱਚ ਕਾਫੀ ਮਦਦ ਮਿਲਦੀ ਹੈ ਅਤੇ ਬਾਕੀ ਸਵੇਰੇ ਅਗਰ ਤੁਸੀਂ ਰਨਿੰਗ ਕਰਦੇ ਹੋ ਤਾਂ ਉਸ ਨਾਲ ਵੀ ਤੁਹਾਡੀ ਭਾਰ 'ਚ ਕਾਫੀ ਮ ਫਾਇਦਾ ਹੁੰਦਾ ਹੈ ਕਿ ਮਤਲਬ ਤੁਹਾਡਾ ਜਿਹੜਾ ਭਾਰ ਹੈ ਕਾਫੀ ਲੋਸ ਹੁੰਦਾ ਉਹਦੇ ਨਾਲ ਅਤੇ ਬਾਕੀ ਤੁਸੀਂ ਮੈਡੀਟੇਸ਼ਨ ਕਰ ਸਕਦੇ ਹੋ ਐਕਸਰਸਾਈਜ਼ ਵਗੈਰਾ ਕਰ ਸਕਦੇ ਹੋ ਕਈ ਤਕਨੀਕ ਨਾਲ ਤੁਸੀਂ ਆਪਣਾ ਭਾਰ ਘਟਾ ਸਕਦੇ ਹੋ ਅਤੇ ਇਹ ਚੀਜ਼ਾਂ ਅਸੀਂ ਅਗਰ ਆਪਣੇ ਜੀਵਨ ਵਿੱਚ ਅਪ ਅਪਣਾਈਏ ਅਸੀਂ ਤਾਂ ਅਸੀਂ ਕੁਛ ਟਾਈਮ ਤੱਕ ਆਪਣਾ ਭਾਰ ਘਟਾ ਸਕਦੇ ਹਨ